ਮੈਨੂੰ ਕਿਤਾਬਾਂ ਪੜ੍ਹਨਾ ਬਹੁਤ ਵਧੀਆ ਲੱਗਦਾ ਹੈ ਹਰ ਹਫ਼ਤੇ ਕਿਸੇ ਨਵੀਂ ਕਿਤਾਬ ਨੂੰ ਖਰੀਦਣਾ ਅਤੇ ਉਸਨੂੰ ਪੜ੍ਹਨਾ ਮੇਰਾ ਪਹਿਲਾ ਨਿਸ਼ਾਨਾ ਹੁੰਦਾ ਹੈ ਪਿਛਲੇ ਹਫ਼ਤੇ ਹੀ ਮੈਂ ਇੱਕ ਕਿਤਾਬ ਜਿਸਦਾ ਨਾਂ ਗੁਡ ਵਾਈਬਸ ਗੁੱਡ ਲਾਈਫ ਹੈ ਪੜ੍ਹੀ ਇਹ ਕਿਤਾਬ ਅੰਤਰਮੁਖੀ ਲੋਕਾਂ ਦੇ ਬਾਰੇ ਹੈ ਇਹ ਕਿਤਾਬ ਅੰਤਰਮੁਖੀ ਲੋਕਾਂ ਨੂੰ ਲੋਕਾਂ ਵਿੱਚ ਵਿਚਰਨਾ ਸਿਖਾਉਂਦੀ ਹੈ ਨਾਲ ਹੀ ਇਹ ਕਿਤਾਬ ਆਪਣੇ ਮਿੱਥੇ ਟੀਚਿਆਂ ਨੂੰ ਕਿਵੇਂ ਹਾਸਿਲ ਕਰਨਾ ਹੈ ਉਸ ਬਾਰੇ ਵੀ ਦੱਸਦੀ ਹੈ ਇਸ ਕਿਤਾਬ ਦੀ ਇੱਕ ਅਨੋਖੀ ਕਹਾਣੀ ਜਿਸ ਵਿੱਚ ਲੇਖਕ ਨੇ ਲੋਅ ਔਫ ਅਟਰੈਕਸ਼ਨ ਰਾਹੀਂ ਆਪਣੇ ਟੀਚਿਆਂ ਨੂੰ ਕਿਵੇਂ ਹਾਸਿਲ ਕਰਨਾ ਹੈ ਉਸ 'ਤੇ ਚਾਨਣਾ ਪਾਇਆ ਹੈ ਇਸ ਤਰੀਕੇ ਨਾਲ ਇਹ ਕਿਤਾਬ ਮੇਰੀ ਮਨ ਪਸੰਦ ਹੈ ਅਤੇ ਮੈਂ ਸਭ ਨੂੰ ਸੁਜੈਸਟ ਕਰਦੀ ਹਾਂ ਕਿ ਸਭ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ